ਭੰਗੜਾ ਪੰਜਾਬੀਆਂ ਦਾ ਪ੍ਰਸਿੱਧ ਬਹੁਤ ਹੀ ਪ੍ਰਸਿੱਧ ਲੋਕ ਨਾਚ ਹੈ ਇਹ ਪੰਜਾਬੀਆਂ ਲਈ ਬਹੁਤ ਹੀ ਪ੍ਰਸਿੱਧ ਹੈ ਇਹ ਇਸ ਇਹ ਪਾਰਟੀਆਂ 'ਚ ਵਿਆਹਾਂ 'ਚ ਹਰ ਭੰਗੜਾ ਕੀਤਾ ਜਾਂਦਾ ਹੈ ਭੰਗੜੇ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਜਿੱਥੇ ਵੀ ਵਿਆਹ ਹੁੰਦਾ ਹੈ ਸਭ ਤੋਂ ਪਹਿਲਾਂ ਭੰਗੜਾ ਹੀ ਕੀਤਾ ਜਾਂਦਾ ਹੈ ਇਸ ਨਾਲ ਲੋਕਾਂ ਦਾ ਮਨੋਰੰਜਨ ਵੀ ਹੁੰਦਾ ਹੈ ਅਤੇ ਲੋਕ ਵਧੀਆ ਨੱਚਦੇ ਟੱਪਦੇ ਖੇਡਦੇ ਰਹਿੰਦੇ ਹਨ ਅਤੇ ਇਹ ਹਰੇਕ ਥਾਂ ਕੀਤਾ ਜਾਂਦਾ ਹੈ ਇਸ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ ਅਤੇ ਅਸੀਂ ਹਰੇਕ ਕੰਮ ਵਿੱਚ ਭੰਗੜੇ ਨੂੰ ਸਭ ਤੋਂ ਅੱਗੇ ਰੱਖਦੇ ਹਾਂ ਅਤੇ ਭੰਗੜਾ ਸਾਡੇ ਜੀਵਨ ਲਈ ਬਹੁਤ ਹੀ ਮਹੱਤਵਪੂਰਨ ਹੈ ਸ ਸੰਗੀਤ ਦੀ ਭੂ ਭੂਮਿਕਾ ਵੀ ਬਹੁਤ ਹੀ ਵਧੀਆ ਹੈ ਇਹ ਭੰਗੜਾ ਸੰਗੀਤ ਸਾਡੇ ਮਨੋਰੰਜਨ ਦਾ ਸਾਧਨ ਹਨ ਪੰਜਾਬੀ ਆਪਣਾ ਮਨੋਰੰਜਨ ਇਹਨਾਂ ਭੰਗੜਿਆਂ ਨਾਲ ਕਰਦੇ ਹਨ ਪਹਿਲਾਂ ਦੇ ਲੋਕ ਮੇਲਿਆਂ ਵਿੱਚ ਜਾਂਦੇ ਅਤੇ ਭੰਗੜਾ ਕਰਨ ਲੱਗ ਜਾਂਦੇ ਅਤੇ ਉਹ ਵਧੀਆ ਤਰੀਕੇ ਨਾਲ ਕਰਦੇ ਅਤੇ ਵਧੀਆ ਮਨੋਰੰਜਨ ਕਰਦੇ ਆਪਣਾ